ਮੈਂ ਅੱਜ ਰਾਜਧਾਨੀ ਐਕਸਪੈਕਟ ਤੋਂ ਆਪਣੇ ਪਿੰਡ 'ਚ ਆਈ ਸਾਂ ਅਤੇ ਉਸ ਵਿੱਚ ਮੈਨੂੰ ਇੱਕ ਵਿਅਕਤੀ ਜਖ਼ਮੀ ਲੱਭਿਆ ਅਤੇ ਮੈਂ ਇੱਕ ਵਿਅਕਤੀ ਨੂੰ ਕਾਲ ਕਰ ਰਿਹਾ ਸਾਂ ਮੈਂ ਉਹਨਾਂ ਨੂੰ ਫੋਨ ਕਰਕੇ ਕਿਹਾ ਕਿ ਮੈਨੂੰ ਟ੍ਰੇਨ ਦੇ ਵਿੱਚ ਇੱਕ ਵਿਅਕਤੀ ਜਖ਼ਮੀ ਲੱਭਿਆ ਹੈ ਜਿਸਦੇ ਬਹੁਤ ਸੱਟਾਂ ਵੱਜੀਆਂ ਹੋਈਆਂ ਹਨ ਜਿਸਦਾ ਸਮਾਨ ਵੀ ਚੋਰੀ ਹੋ ਗਿਆ ਹੈ ਅਤੇ ਉਸਦੇ ਮੱਥੇ ਉੱਤੇ ਸੱਟ ਵੱਜੀ ਹੈ ਉਸਦੇ ਹੱਥ ਉੱਤੇ ਸੱਟ ਵੱਜੀ ਹੈ ਉਸਦੇ ਪੈਰ 'ਤੇ ਵੀ ਕਾਫੀ ਸੱਟ ਵੱਜੀ ਹੈ ਉਹਨਾਂ ਨੂੰ ਮੈਂ ਫੋਨ ਕਰਕੇ ਇਨ੍ਹਾਂ ਸਾਰੇ ਸੂਚੀਆਂ ਬਾਰੇ ਦੱਸਿਆ ਅਤੇ ਉਹ ਮੈਨੂੰ ਉਸ ਟੈਮ 'ਤੇ ਨਾਲ ਦੀ ਨਾਲ ਨੈਕਸਟ ਸਟੇਸ਼ਨ 'ਤੇ ਉਹ ਆ ਗਏ ਸਾਂ